ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਸਵੀਗੀ ਤੋਂ ਗੱਲ ਕਰ ਰਹੇ ਹੋ ਜੀ ਸਰ ਮੈਂ ਆਪਣੇ ਔਡਰ ਦੇ ਵਿੱਚ ਕੱਲ੍ਹ ਤਿੰਨ ਚਾਰ ਖਾਣ ਵਾਲੇ ਆਈਟਮ ਔਡਰ ਕੀਤੇ ਸੀ ਉਹਦੇ ਵਿੱਚ ਆਪਣਾ ਸਮੋਸੇ ਸੀਗੇ ਨਿਊਡਲ ਅਤੇ ਬਰਗਰ ਸੀਗੇ ਜੀ ਅਤੇ ਕੋਲਡ ਡਰਿੰਕ ਸੀ ਅਤੇ ਕੋਲਡ ਕੌਫੀ ਵਗੈਰਾ ਅਤੇ ਤੁਹਾਡਾ ਸਵੀਗੀ ਦਾ ਜੋ ਵੀ ਪਰਸਨ ਮੈਨੂੰ ਡਲੀਵਰ ਕਰਨ ਆਇਆ ਸੀ ਉਹ ਬਹੁਤ ਜ਼ਿਆਦਾ ਲੇਟ ਹੋ ਗਿਆ ਲੇਟ ਹੋਣ ਕਾਰਨ ਸਾਰੀ ਡ੍ਰਿੰਕਿੰਗ ਵਗੈਰਾ ਖਰਾਬ ਹੋ ਗਈ ਜ਼ਿਆਦਾ ਹੋਟ ਹੋ ਗਈ ਅਤੇ ਪੀਜੇ ਵਗੈਰਾ ਬਿਲਕੁਲ ਖਰਾਬ ਹੋ ਗਏ ਸੀ ਇਸ ਕਰਕੇ ਜ਼ਿਆਦਾ ਡਿਲੇਅ ਹੋਣ ਕਾਰਨ ਮੈਨੂੰ ਆਪਣੇ ਗੈਸਟ ਦੇ ਸਾਹਮਣੇ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਅਤੇ ਮੈਂ ਇਸ ਚੀਜ਼ ਦੇ ਤੁਹਾਡੇ ਔਡਰ ਦੇ ਪ੍ਰਤੀ ਜ਼ਿਆਦਾ ਖੁਸ਼ ਨਹੀਂ ਮੈਨੂੰ ਇਸ ਕਰਕੇ ਅੱਗੇ ਤੋਂ ਵੀ ਸਵੀਗੀ 'ਤੇ ਔਡਰ ਕਰਨਾ ਚੰਗਾ ਨਹੀਂ ਲੱਗਣਾ ਮੈਂ ਆਪਣਾ ਜਿਹੜਾ ਵੀ ਆਈਟਮਸ ਦਾ ਪੈਸੇ ਆ ਉਹ ਮੈਂ ਆਪਣੇ ਵਾਪਸ ਲੈਣਾ ਚਾਹੁੰਦਾ ਮੈਨੂੰ ਆਪਣੇ ਪੈਸੇ ਰਿਫੰਡ ਕੀਤੇ ਜਾਣ ਅਤੇ ਮੈਂ ਆਪਣਾ ਕੋਈ ਨਾ ਉਹ ਕਰਾਂ ਅਤੇ ਮੈਨੂੰ ਕੁਛ ਵੀ ਇਸ ਬਾਰੇ ਤੁਹਾਡੇ ਤੋਂ ਆਪਣਾ ਔਡਰ ਕਰਕੇ ਕੁਛ ਚੰਗਾ ਨਹੀਂ ਲੱਗਿਆ ਮੇਰੇ ਜਲਦੀ ਤੋਂ ਪੈਸੇ ਰਿਫੰਡ ਕਰਿਓ